ਇੱਕ ਅਗਸਤ ਉੱਨੀ ਸੌ ਪਚਾਸੀ ਦਸ ਅਕਤੂਬਰ ਉੱਨੀ ਸੌ ਸਤਾਸੀ ਉੱਨੀ ਨਵੰਬਰ ਦੋ ਹਜ਼ਾਰ ਵੀਹ ਪੰਦਰਾਂ ਅਗਸਤ ਉੱਨੀ ਸੌ ਸੰਤਾਲੀ ਛੱਬੀ ਨਵੰਬਰ ਉੱਨੀ ਸੌ ਪੰਜਾਹ